ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਡਮ ਫਤਿਹਗੜ੍ਹ ਸਾਹਿਬ ਤੋਂ ਬੋਲਦੇ ਆ ਜੀ ਹਾਂਜੀ ਮੈਡਮ ਜੀ ਮੈਂ ਕੈਨੇਡਾ ਤੋਂ ਬੋਲ ਰਹੀ ਹਾਂ ਮੈਨੂੰ ਮੇਰੀ ਫਰੈਂਡ ਨੇ ਤੁਹਾਡਾ ਨੰਬਰ ਦਿੱਤਾ ਸੀ ਅਤੇ ਹਾਂਜੀ ਮੈਂ ਫਤਿਹਗੜ੍ਹ ਸਾ ਕਾਫੀ ਸਾਲਾਂ ਤੋਂ ਬਾਅਦ ਆਉਣਾ ਜੀ ਮੇਰਾ ਮਨ ਹੈ ਫਤਿਹਗੜ੍ਹ ਸਾਹਿਬ ਗੁਰੂ ਘਰ ਦਰਸ਼ਨ ਕਰਨ ਦਾ ਅਤੇ ਤੁਸੀਂ ਮੈਨੂੰ ਇੱਥੇ ਬਾਰੇ ਦੱਸ ਸਕਦੇ ਹੋ ਜੀ ਕੋਈ ਹੋਰ ਮਤਲਬ ਜੋ ਵੀ ਸਥਾਨ ਨੇ ਦਰਸ਼ਨ ਕਰਨ ਵਾਸਤੇ ਬਾਕੀ ਮੌਸਮ ਦਾ ਵੀ ਕਿਸ ਤਰ੍ਹਾਂ ਸਹੀ ਰਹੇਗਾ ਮੈਂ ਦਸੰਬਰ 'ਚ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਨਹੀਂ ਇਹ ਕੋਈ ਜ਼ਿਆਦਾ ਦੂਰੀ 'ਤੇ ਤਾਂ ਨਹੀਂ ਹੈਗੇ ਗੁ ਗੁਰਦੁਆਰਾ ਸਾਹਿਬ ਮਤਲਬ ਜਿਵੇਂ ਦਰਸ਼ਨ ਕਰਨੇ ਜੇ ਆਪਾਂ ਨੂੰ ਕਈ ਦਿਨ ਚਾਹੀਦੇ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ

ਠੀਕ ਹੈ ਨਹੀਂ ਚਲੋ ਸਟੇਅ ਕਰ ਸਕਦੇ ਹਾਂ ਜੀ ਠੀਕ ਹੈ ਜੀ ਠੀਕ ਹੈ ਦੱਸ ਸਕਦੇ ਆ ਜੀ ਇੱਕ ਤਾਂ ਮੇਨ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹੈ ਅਤੇ ਬਾਕੀ ਹੋਰ ਠੀਕ ਹੈ ਜੀ ਠੀ ਇੱਕ ਹੋਰ ਗੁਰਦੁਆਰਾ ਸਾਹਿਬ ਮੈਡਮ ਦੱਸਦੇ ਹੁੰਦੇ ਆ ਕਿ ਜਿਵੇਂ ਵੀ ਜਿੱਥੇ ਕ ਗਲਾਸਾਂ ਦਾ ਕੋਈ ਇਤਿਹਾਸ ਹੈ ਉਹ ਕਿੰਨੀ ਕੁ ਦੂਰੀ 'ਤੇ ਹੈ ਠੀ ਠੀਕ ਹੈ ਜੀ ਠੀਕ ਠੀਕ ਹੈ ਜੀ ਥੈਂਕ ਯੂ ਜੀ ਥੈਕ ਯੂ ਜੀ ਸਤਿ ਸ਼੍ਰੀ ਅਕਾਲ ਮੈਡਮ